ਹੈਲੋ ਨਮਸਕਾਰ ਜੀ ਮੈਂ ਨਰੇਸ਼ ਕੁਮਾਰ ਬੋਲ ਰਿਹਾ ਮੈਨੂੰ ਯਾਤਰਾ ਕਰਨਾ ਜਾਂ ਘੁੰਮਣਾ ਫਿਰਨਾ ਬਹੁਤ ਪਸੰਦ ਹੈ ਬਿਜਨਸ ਦੇ ਵਾਸਤੇ ਵੀ ਮੈਨੂੰ ਹਿਮਾਚਲ ਵਗੈਰਾ ਜੇ ਐਡ ਕੇ ਵਗੈਰਾ ਜਾਣਾ ਪੈਂਦਾ ਇੱਕ ਤਾਂ ਮੈਂ ਆਪਣਾ ਮਨੋਰੰਜਨ ਕਰ ਲੈਂਦਾ ਘੁੰਮਦਾ ਫਿਰਦਾ ਰਹਿੰਦਾ ਆ ਦੂਸਰਾ ਮੇਰਾ ਕੰਮ ਵੀ ਹੋ ਜਾਂਦਾ ਬਿਜ਼ਨਸ ਵੀ ਹੋ ਜਾਂਦਾ ਹੈ ਅਤੇ ਯਾਤਰਾ ਕਰਨਾ ਮੈਨੂੰ ਬਹੁਤ ਪਸੰਦ ਹੈ ਮਨੀਮਹੇਸ਼ ਯਾਤਰਾ ਮੈਂ ਹਰ ਸਾਲ ਜਾਂਦਾ ਹਾਂ ਅਮਰਨਾਥ ਯਾਤਰਾ ਵੀ ਅਤੇ ਚਾਰ ਪੰਜ ਸਾਲ ਹੋ ਗਿਆ ਮੈਨੂੰ ਲਗਾਤਾਰ ਜਾ ਰਿਹਾ ਮੈਂ ਜਾਂਦੇ ਰਹੇ ਦੇ ਕਰੋਨਾ ਟਾਈਮ ਕਰਕੇ ਮੇਰੀ ਯਾਤਰਾਵਾਂ ਥੋੜ੍ਹੀਆਂ ਗੈਪ ਪਿਆ ਸੀਗਾ ਨਹੀਂ ਤਾਂ ਮੈਂ ਹਰ ਸਾਲ ਯਾਤਰਾਵਾਂ ਜਾਂਦਾ ਰਹਿੰਦਾ ਵੈਸ਼ਨੋ ਮਾਤਾ ਇੱਕ ਦੋ ਟੂਰ ਸਾਲ ਦੇ ਵਿੱਚ ਮੈਂ ਲਗਾਉਂਦਾ ਰਹਿੰਦਾ ਹਾਂ ਯਾਤਰਾ ਮੈਨੂੰ ਬਹੁਤ ਪਸੰਦ ਆ ਧਾਰਮਿਕ ਜਗ੍ਹਾ ਮੈਨੂੰ ਬਹੁਤ ਪਸੰਦ ਆਉਂਦੀਆਂ ਨੇ ਬ ਬੜਾ ਮਨੋਰੰਜਨ ਕਰਦਾ ਮੈਂ ਵੈਸ਼ਨੂੰ ਮਾਤਾ ਜਾਈਏ ਅਸੀਂ ਬਰ ਮਾਨਸਰ ਝੀਲ ਜਾਈਦਾ ਉੱਥੇ ਘੁੰਮੀਦਾ ਆ ਝੀਲ ਦੇ ਵਿੱਚ ਮਨੋਰੰਜਨ ਕਰੀਦਾ ਪੂਰਾ ਜਮ ਜੰਮੂ ਜਾਈਦਾ ਬਾਗੇ ਵੋ ਬਾਗਵਾਨੀ ਮਾਤਾ ਪਾਰਕ ਬ ਬਹੁਤ ਵੱਡਾ ਬਹੁਤ ਪਾਰਕ ਹੈਗਾ ਉੱਥੇ ਇੰਜੋਏ ਕ ਕਰੀਦਾ ਘੁੰਮੀਦਾ ਫਿਰੀਦਾ ਸਨੈਪਸ ਵਗੈਰਾ ਲਈ ਦੀਆਂ ਫੋਟੋਆਂ ਫਿਰ ਉੱਪਰ ਬ ਬਾਗ ਵਾਲੀ ਮਾਤਾ ਦਾ ਮੰਦਿਰ ਹੈ ਉੱਥੇ ਮੱਥਾ ਟੇਕੀਦਾ ਉੱਥੋਂ ਵਿਊ ਬਹੁਤ ਸ਼ਾਨਦਾਰ ਲੱਗਦਾ ਤਵੀ ਦਰਿਆ ਲਾਗੇ ਪੈਂਦਾ ਆ ਉਹਦਾ ਵਿਊ ਬਹੁਤ ਸ਼ਾਨਦਾਰ ਆਉਂਦਾ ਹੈ ਫਿਰ ਅਸੀਂ ਵੈਸ਼ਨੋ ਮਾਤਾ ਦਰਸ਼ਨ ਕਰੀਦੇ ਆ ਉਹਦਾ ਵਿਊ ਬਹੁਤ ਸ਼ਾਨਦਾਰ ਦਰਸ਼ਨ ਕਰਨ ਦਾ ਬਹੁਤ ਮਜ਼ਾ ਆਉਂਦਾ ਸੁੱਖ ਸ਼ਾਂਤੀ ਮਿਲਦੀ ਹੈ ਮਨੀਮਹੇਸ਼ ਜਾਈਏ ਉੱਧਰ ਦਾ ਵਿਊ ਬਹੁਤ ਸ਼ਾਨਦਾਰ ਪਹਾੜ ਉੱਚੇ ਉੱਚੇ ਪਹਾੜ ਨਜ਼ਰ ਆਉਂਦੇ ਨੇ ਬਰਫ਼ ਨਾਲ ਢੱਕੇ ਹੋਏ ਨਜ਼ਰ ਆਉਂਦੇ ਨੇ ਬੜੀ ਵਧੀਆ ਯਾਤਰਾ ਲੱਗਦੀ ਹੈ ਉੱਥੇ ਇਸ਼ਨਾਨ ਕਰਕੇ ਪੂਰੀ ਥਕਾਵਟ ਦੂਰ ਹੋ ਜਾਂਦੀ ਹੈ ਤੁਸੀਂ ਵੀ ਮੇਰੇ ਨਾਲ ਇੱਕ ਵਾਰ ਯਾਤਰਾ ਦਾ ਮਨੋਰੰਜਨ ਪੂਰਾ ਕਰੋ ਸ਼ੁਕਰੀਆ